ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਬਰਨ ਜਿੰਮ ਕਪੂਰਥਲੇ ਤੋਂ ਗੱਲ ਕਰ ਰਹੇ ਹੋ ਜੀ ਭਾਅ ਜੀ ਮੈਂ ਤੁਹਾਡੀ ਇੱਕ ਨਾ ਐਡ ਦੇਖੀ ਸੀ ਦੋ ਤਿੰਨ ਦਿਨ ਪਹਿਲਾਂ ਕਿ ਤੁਸੀਂ ਯੋਗਾ ਕਰਵਾਉਂਦੇ ਹੋ ਹਾਂਜੀ ਭਾਅ ਜੀ ਮੈਂ ਤੁਹਾਨੂੰ ਪੁੱਛਣਾ ਸੀ ਵੀ ਤੁਹਾਡਾ ਜਿਹੜਾ ਜਿੰਮ ਹੈਗਾ ਯੂਨੀਸੈਕਸ ਹੈ ਔਨਲੀ ਮੇਲ ਹੈ ਫੀਮੇਲ ਹੈ ਯੂਨੀਸੈਕਸ ਹੈ ਅਤੇ ਤੁਹਾਡੇ ਇੱਥੇ ਮਤਲਬ ਟਾਈਮਿੰਗ ਕੀ ਵਗੈਰਾ ਹੈਗੇ ਹੈ ਅਗਰ ਕਿਸੇ ਨੇ ਯੋਗਾ ਐਜ ਏ ਯੋ ਯੋਗਾ ਯੋਗਾ ਕਰਨ ਵਾਸਤੇ ਆਉਣਾ ਹੋਵੇ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਓਕੇ ਜੀ ਅਤੇ ਮੈਂ ਪੁੱਛਣਾ ਸੀ ਜਿੱਦਾਂ ਮੇਰੀ ਨਾ ਵਾਈਫ ਇੰਨਸਟਰਸਟਡ ਇੰਨਸਟਰਸਟਡ ਹੈਗੇ ਤੁਹਾਡੇ ਇੱਥੇ ਜੁਆਇਨ ਕਰਨ ਵਾਸਤੇ ਤੁਹਾਡੇ ਇੱਥੇ ਫੀਮੇਲ ਟੂ ਫੀਮੇਲ ਹੁੰਦਾ ਜਾਂ ਮੇਲ ਟੂ ਫੀਮੇਲ ਕਿੱਦਾਂ ਮਤਲਬ ਕ੍ਰੋਸ ਕਰਵਾਉਂਦੇ ਹੋ ਤੁਸੀਂ ਯੋਗਾ

ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੇਟ ਲੋਸ 'ਚ ਮਤਲਬ ਯੋਗਾ ਹੈਲਪ ਕਰਦੀ ਹੈ ਜਿੱਦਾਂ ਉਹਨਾਂ ਨੇ ਵੇਟ ਲੋਸ ਕਰਨਾ ਉਹਨਾਂ ਦਾ ਵੇਟ ਕਾਫੀ ਹੈਗਾ ਹਾਂਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅਤੇ ਤੁਹਾਡੀ ਫੀਸ ਵਗੈਰਾ ਕੀ ਹੈਗੀ ਉਹਦੀ ਪੈਕਜ ਵਗੈਰਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸਰ ਮੈਂ ਤੁਹਾਨੂੰ ਫਿਰ ਦੱਸਦਾ ਕੋਲ ਕਰਕੇ ਮੈਂ ਘਰ ਸਲਾਹ ਕਰਕੇ ਤੁਹਾਨੂੰ ਫਿਰ ਮੈਂ ਕੋਲ ਬੈਕ ਕਰਦਾ ਜੀ ਓਕੇ ਓਕੇ ਥੈਂਕੂ ਯੂ